ਅੱਜ ਕੱਲ੍ਹ ਪੰਜਾਬ ਵਿੱਚ ਨਵੀਂ ਤੋਂ ਨਵੀਂ ਟੈਕਨੋਲਜੀ ਆ ਗਈ ਹੈ ਜਿਸ ਰਾਹੀਂ ਵਿਅਕਤੀਆਂ ਨੂੰ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਵੀਂ ਤੋਂ ਨਵੀਂ ਟੈਕਨੋਲਜੀ ਨਾਲ ਵਿਅਕਤੀ ਘਰ ਬੈਠੇ ਹੀ ਆਪਣਾ ਕੰਮ ਕਰ ਸਕਦਾ ਹੈ ਉਸ ਨੂੰ ਕਿਤੇ ਆਉਣ ਜਾਣ ਦੀ ਵੀ ਨਹੀਂ ਲੋੜ ਪੈਂਦੀ ਉਹ ਘਰ ਬੈਠੇ ਹੀ ਟੈਕਨੋਲਜੀ ਰਾਹੀਂ ਆਪਣਾ ਕੰਮ ਕਰ ਸਕਦਾ ਹੈ ਇਹ ਟੈਕਨੋਲਜੀ ਨੇ ਪੰਜਾਬ ਵਿੱਚ ਬਹੁਤ ਵਧੀਆ ਇਤਿਹਾਸ ਬਣਾਇਆ ਹੈ ਜਿਸ ਰਾਹੀਂ ਵਿਅਕਤੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਉਹ ਆਪਣਾ ਕੰਮ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਇਹ ਬਹੁਤ ਵਧੀਆ ਕੰਮ ਹੋ ਗਿਆ ਹੈ ਜੋ ਪੰਜਾਬ ਵਿੱਚ ਨਵੀਂ ਟੈਕਨੋਲਜੀ ਆ ਗਈ ਹੈ ਇਸ ਰਾਹੀਂ ਪੰਜਾਬ ਨੇ ਬਹੁਤ ਤਰੱਕੀ ਹਾਸਲ ਕੀਤੀ ਹੈ ਇਸ ਤਰ੍ਹਾਂ ਹੀ ਪੰਜਾਬ ਵਿੱਚ ਨਵੀਂ ਤੋਂ ਨਵੀਂ ਟੈਕਨੋਲਜੀ ਆਉਂਦੀ ਰਹੇ ਤਾਂ ਜੋ ਕਿ ਪੰਜਾਬ ਤਰੱਕੀ ਵੱਲ ਵੱਧਦਾ ਰਹੇ